ਹਾਂਜੀ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਨਾ ਇਸ਼ਾਨ ਦੀ ਸਕੂਲ ਟੀਚਰ ਬੋਲਦੀ ਪਈ ਹਾਂ ਹਾਂਜੀ ਮੈਮ ਹੋਰ ਕੀ ਹਾਲ ਚਾਲ ਵਧੀਆ ਹਾਂ ਹਾਂਜੀ ਹਾਂਜੀ ਹੋਰ ਮੈਮ ਇਸ਼ਾਨ ਘਰ ਸਟੱਡੀ ਵਗੈਰਾ ਕਰਦਾ ਪੜ੍ਹਦਾ ਹਾਂਜੀ ਮੈਮ ਇਹਦੇ ਸਕੂਲ ਵਿੱਚ ਟੈਸਟ ਲੈਂਦੇ ਸੀ ਆਪਾਂ ਰੈਗੂਲਰਲੀ ਬਟ ਇਹਦੇ ਜਿਹੜੇ ਨੰਬਰ ਬਹੁਤ ਘੱਟ ਆਉਂਦੇ ਨੇ ਨਹੀਂ ਨਹੀਂ ਮੈਮ ਤੁਸੀਂ ਇਹਦੀ ਡਾਇਰੀ ਚੈੱਕ ਕਰਿਆ ਕਰੋ ਇਹਦੇ ਰੋਜ਼ ਦੇ ਮਾਰਕਸ ਉਹਦੀ ਡਾਇਰੀ 'ਤੇ ਲਿਖੇ ਹੁੰਦੇ ਨੇ ਅਤੇ ਬਹੁਤ ਘੱਟ ਆਉਂਦੇ ਪਏ ਨੇ ਮਾਰਕਸ ਹਾਂਜੀ ਹਾਂਜੀ ਹਾਂਜੀ ਮੈਮ ਅਤੇ ਉਹ ਨਾ ਆਪਾਂ ਮੈਂ ਕਹਿਣਾ ਸੀ ਕਿ ਆਪਾਂ ਡਾਇਰੈਕਟਰ ਸਰ ਨਾਲ ਗੱਲ ਕੀਤੀ ਸੀ ਅਤੇ ਉਹ ਸਰ ਨੇ ਕਿਹਾ ਸੀ ਕਿ ਜਿਹੜੇ ਬੱਚਿਆਂ ਦੇ ਤਾਂ ਮਾਰਕਸ ਘੱਟ ਆਉਂਦੇ ਬਟ ਉਹ ਹਾਰਡ ਵਰਕਿੰਗ ਆ ਅਤੇ ਉਹਨਾਂ ਦੀ ਨਾ ਐਕਸਟਰਾ ਕਲਾਸ ਲਗਵਾਓ ਸਕੂਲ ਤੋਂ ਬਾਅਦ ਫੋਰਟੀ ਫੋਰਟੀ ਮਿੰਟ ਜਾਂ ਵਨ ਆਰ ਦੀ ਅਤੇ ਉਹਦੇ ਲਈ ਪਰਮਿਸ਼ਨ ਮੰਗ ਰਹੀ ਸੀ ਮੈਂ ਤੁਹਾਡੇ ਤੋਂ ਹਾਂਜੀ ਹਾਂਜੀ ਮੈਮ ਮੈਂ ਤਾਂ ਪੂਰੀ ਕੋਸ਼ਿਸ਼ ਕਰ ਰਹੀ ਤੁਸੀਂ ਵੀ ਘਰ ਕੋਸ਼ਿਸ਼ ਕਰੋ ਕਿ ਥੋੜ੍ਹਾ ਧਿਆਨ ਦੇ ਸਕੋ ਓਕੇ ਮੈਮ ਧੰਨਵਾਦ